ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਹੋਸ਼ਿਆਰਪੁਰ ਦੇ ਵਿੱਚ ਕਿਹੜੀਆਂ ਕਿਹੜੀਆਂ ਮੈਡੀਕਲ ਸੁਵਿਧਾਵਾਂ ਉਪਲਬਧ ਆ ਅੱਛਾ ਜੀ ਓਕੇ ਜੀ ਜੀ ਮੈਨੂੰ ਤਿੰਨ ਦੇ ਨਾਲ ਰਿਲੇਟਡ ਹੋਸਪਿਟਲ ਬਾਰੇ ਪਤਾ ਕਰਨਾ ਸੀਗਾ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਓਕੇ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਜੀ ਹਾਂਜੀ ਠੀਕ ਆ ਜੀ ਅੱਛਾ ਤੁਸੀਂ ਮੈਨੂੰ ਦੱਸ ਸਕਦੇ ਆ ਕਿ ਬਸ ਸਟੈਂਡ ਦੇ ਲਾਗੇ ਕਿਹੜੇ ਕਿਹੜੇ ਹੋਸਪੀਟਲ ਹੈਗੇ ਆ ਅੱਛਾ ਜੀ ਓਕੇ ਜੀ ਠੀਕ ਆ ਜੀ ਤੇ ਮੈਨੂੰ ਕੋਈ ਇਦਾਂ ਦਾ ਹੋਸਪਿਟਲ ਦੱਸ ਸਕਦੇ ਹੋ ਜਿੱਥੇ ਕਿ ਜੋ ਟੈਸਟ ਆ ਉਹ ਬਹੁਤ ਹੀ ਘੱਟ ਰੇਟਾਂ ਤੇ ਹੁੰਦੇ ਹੋਣ ਠੀਕ ਆ ਜੀ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਜੇ ਮੈਨੂੰ ਫਿਰ ਤੋਂ ਦੁਬਾਰਾ ਲੋੜ ਪਈ ਤੁਹਾਨੂੰ ਮੈਂ ਤੁਹਾਨੂੰ ਫੋਨ ਕਰਾਂਗੀ ਹਾਂਜੀ ਠੀਕ ਆ